ਗੱਲ ਕਰੀਏ ਰੂਪਨਗਰ ਜ਼ਿਲ੍ਹੇ ਦੀ ਅਤੇ ਜਿਹੜਾ ਅੱਜ ਕੱਲ੍ਹ ਇਹ ਰੋਪੜ ਦੇ ਜ਼ਿਲ੍ਹੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਹਦਾ ਇਤਿਹਾਸ ਦੀ ਗੱਲ ਕਰੀਏ ਤਾਂ ਇੱਥੇ ਹੜੱਪਾ ਦੀ ਸੱਭਿਅਤਾ ਜਿਹੜੀ ਸਭ ਨਾਲੋਂ ਪੁਰਾਣੀ ਸੱਭਿਅਤਾ ਉਹ ਇੱਥੇ ਪਾਈ ਜਾਂਦੀ ਹੈ ਅਤੇ ਇੱਥੇ ਇੱਕ ਹੜੱਪਾ ਦੀ ਸੱਭਿਅਤਾ ਦੇ ਸਾਰੇ ਜਿਹੜੇ ਭਾਂਡੇ ਸੀਗੇ ਜਾਂ ਕੋਈ ਹੋਰ ਸਿੱਕੇ ਸੀਗੇ ਪੁਰਾਣੇ ਤੋਂ ਪੁਰਾਣੇ ਉਹ ਸਾਰੇ ਸਾਂਭ ਕੇ ਲਾਇਬ੍ਰੇਰੀ ਦੇ ਵਿੱਚ ਰੱਖੇ ਹੋਏ ਨੇ ਅਤੇ ਗੱਲ ਕਰੀਏ ਚੰਦਰਗੁਪਤ ਮੋਰੀਆ ਨੇ ਇੱਥੇ ਆ ਕੇ ਸਭ ਨਾਲੋਂ ਪਹਿਲਾਂ ਆਪਣਾ ਰਾਜ ਸਥਾਪਿਤ ਕੀਤਾ ਸੀ ਅਤੇ ਇੱਕ ਹੋਰ ਹੈ ਇਹ ਸਭ ਨਾਲੋਂ ਵਧੀਆ ਕਿ ਇਹ ਜਿਹੜਾ ਰੂਪਨਗਰ ਇਲਾਕਾ ਏ ਚੰਡੀਗੜ੍ਹ ਦੇ ਬਹੁਤ ਜ਼ਿਆਦਾ ਨੇੜੇ ਲੱਗਦਾ ਹੈ ਠੀਕ ਹੈ ਅਤੇ ਬਹੁਤ ਜ਼ਿਆਦਾ ਹੁਣ ਇਹ ਵਿਕਸਿਤ ਹੋ ਰਿਹਾ ਹੈ ਅਤੇ ਦਿਨ ਪਰ ਦਿਨ ਇੱਥੇ ਨਵੀਆਂ ਬਿਲਡਿਗਾਂ ਤਿਆਰ ਹੋ ਰਹੀਆਂ ਨੇ ਨਵੇਂ ਪਾਰਕ ਬਣ ਰਹੇ ਨੇ ਠੀਕ ਹੈ ਅਤੇ ਨਵੇਂ ਕਾਫ਼ੀ ਪ੍ਰੋਜੈਕਟ ਆ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਅਤੇ ਗੱਲ ਕਰੀਏ ਇਸ ਜ਼ਿਲ੍ਹੇ ਦੀ ਪ੍ਰਸਿੱਧ ਇਤਿਹਾਸਿਕ ਸ਼ਖਸੀਅਤਾਂ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਹੋ ਗਿਆ ਸਿੱਖ ਦਾ ਇਤਿਹਾਸ ਹੈ ਜ਼ਿਆਦਾ ਕਰਕੇ ਜਿਹੜੀਆਂ ਸਾਡੀਆਂ ਸਿੱਖ ਦੀ ਕੁਰਬਾਨੀਆਂ ਸਿੱਖਾਂ ਦੇ ਧਾਰਮਿਕ ਦੀ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਉਹ ਰੋਪੜ ਜ਼ਿਲ੍ਹੇ ਦੇ ਵਿੱਚ ਹੀ ਦਿੱਤੀਆਂ ਹੋਈਆਂ ਜਿਹੜੀ ਰੋਪੜ ਦੀ ਧਰਤੀ ਨੂੰ ਆਹ ਸ਼ਹੀਦਾਂ ਦੀ ਧਰਤੀ ਕਿਹਾ ਜਾਂਦਾ ਹੈ ਅਤੇ ਇਸਦੇ ਵਿੱਚ ਸਾਡੇ ਚਾਰ ਸਾਹਿਬਜ਼ਾਦੇ ਵਿੱਚੋਂ ਦੋ ਸਾਹਿਬਜ਼ਾਦੇ ਚਮਕੌਰ ਦੀ ਧਰਤੀ 'ਤੇ ਸ਼ਹੀਦ ਹੋਏ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਸਰਸਾ ਨਦੀ 'ਤੇ ਵਿ ਆ ਕੇ ਵਿਛੋੜਾ ਦਿੱਤਾ ਅਤੇ ਹੋਰ ਕਾਫ਼ੀ ਇੱਥੇ ਜਿਹੜਾ ਰੋਪੜ ਦੇ ਵਿੱਚ ਸ਼ਖਸੀਅਤਾਂ ਨੇ ਇੱਥੇ ਜਨਮ ਲਿੱਤਾ ਹੈ